ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਹਾਂਜੀ ਹਾਂਜੀ ਅੱਛਾ ਮਿਲ ਜਾਏਗਾ ਜੀ ਕਿਸ ਦਿਨ ਆਉਣਾ ਜੀ ਤੁਸੀਂ ਅੱਛਾ ਜੀ ਠੀਕ ਹੈ ਜੀ ਕੋਈ ਨਹੀਂ ਆ ਜਾਓ ਮਿਲ ਜਾਏਗਾ ਕਮਰਾ ਕਮਰੇ ਦੀ ਕੋਈ ਚੱਕਰ ਨਹੀਂ ਜੀ ਸੰਗਤਾਂ ਵਾਸਤੇ ਹੀ ਬਣੇ ਹੋਏ ਨੇ ਜੀ ਹਾਂਜੀ ਤੁਹਾਨੂੰ ਇੱਥੋਂ ਦੇ ਇਤਿਹਾਸ ਬਾਰੇ ਤਾਂ ਪਤਾ ਹੀ ਹੋਣਾ ਜੀ ਇਹ ਗੁਰੂ ਤੇਗ ਬਹਾਦਰ ਜੀ ਦੀ ਛਰ ਚ ਚਰਨ ਛੋਹ ਪ੍ਰਾਪਤ ਜਗ੍ਹਾ ਜੀ ਇੱਥੇ ਲੋਕੀ ਦੂਰੋਂ ਦੂਰੋਂ ਮੱਥਾ ਟੇਕਣ ਆਉਂਦੇ ਨੇ ਜੀ

ਕਿਸ ਦਿਨ ਆਉਣਾ ਜੀ ਤੁਸੀਂ ਕੱਲ੍ਹ ਨੂੰ ਅੱਛਾ ਜੀ ਪਰਸੋਂ ਆਉਣਾ ਹਾਂਜੀ ਪਰਸੋਂ ਪੈਚਵੀਂ ਜੀ ਪੈਚਵੀਂ 'ਤੇ ਵੀ ਬਹੁਤ ਬਹੁਤ ਦੂਰੋਂ ਦੂਰੋਂ ਸੰਗਤਾਂ ਆਉਂਦੀਆਂ ਮੱਥਾ ਟੇਕਣ ਜੀ ਇਸ਼ਨਾਨ ਕਰਦੇ ਨੇ ਇੱਥੇ ਮੱਥਾ ਟੇਕਣ ਆਉਂਦੇ ਆ ਹਾਂਜੀ ਤੁਸੀਂ ਉਸ ਦਿਨ ਆਉਣਾ ਹਾਂਜੀ ਸਾਰਾ ਦਿਨ ਕੀਰਤਨ ਚੱਲਦਾ ਰਹਿੰਦਾ ਜੀ ਤੁਸੀਂ ਆਓ ਆਪਣਾ ਮੱਥਾ ਟੇਕੋ ਕੀਰਤਨ ਸੁਣੋ ਜੀ ਕਥਾ ਸੁਣੋ ਜੀ ਲੰਗਰ ਛਕੋ ਤੇ ਫਿਰ ਆਪਣੇ ਕਮਰੇ ਏਸੀ ਵਾਲੇ ਦਾ ਸੱਤ ਸੌ ਹੈ ਜੀ ਅਤੇ ਜਿਹੜਾ ਇਹ ਬਿਨਾਂ ਏਸੀ ਤੋਂ ਹੈ ਜੀ ਉਹਦਾ ਪੰਜ ਸੌ ਰੁਪਿਆ ਅਤੇ ਜੇ ਤੁਸੀਂ ਹਾਲ ਹਾਲ ਲੇ ਹਾਲ ਲੈਂਦੇ ਜੀ ਹਾਲ ਦਾ ਫਿਰ ਫ੍ਰੀ ਹੈ ਜੀ ਸ ਸੰਗਤਾਂ ਨਾਲ ਸਾਂਝਾ ਦੂਜਿਆਂ ਨਾਲ ਹਾਂਜੀ ਤੁਸੀਂ ਕਿਹੜਾ ਕਮਰਾ ਲੈਣ ਆਏ ਜੀ ਅੱਛਾ ਜੀ ਠੀਕ ਠੀਕ ਜੀ ਕਰ ਦਿੰਦੇ ਕੋਈ ਨਹੀਂ ਹਾਂਜੀ ਹਾਂਜੀ ਹਾਂਜੀ ਉਸ ਦਿਨ ਆਕੇ ਮੈਨੇਜਮੈਂਟ ਨਾਲ ਗੱਲ ਕਰ ਦੇਵਾਂਗੇ ਉਹ ਦੇ ਦੇ ਦੇਣਗੇ ਕਮਰਾ ਤੁਹਾਨੂੰ ਹਾਂਜੀ ਹਾਂਜੀ ਕੋਈ ਨਹੀਂ ਤੁਸੀਂ ਉੱਥੇ ਆ ਕੇ ਬਸ ਨਾਮ ਲੈ ਦਿਓ ਜੀ ਆਪਣਾ ਕੋਈ ਕਮਰਾ ਮਿਲ ਜਾਏਗਾ ਹਾਂਜੀ ਹਾਂਜੀ ਹਾਂਜੀ ਹਾਂਜੀ ਨਾਲੇ ਪੰਜ ਵਜੇ ਦਰਸ਼ਨ ਹਾਂਜੀ ਬੜੀ ਬੜੀ ਦੂਰੋਂ ਸੰਗਤਾਂ ਆਉਂਦੀਆਂ ਜੀ ਮੱਥਾ ਟੇਕਣ ਬੜੀ ਸ਼ਰਧਾ ਭਾਵਨਾ ਨਾਲ਼ ਹਾਂਜੀ ਹਾਂ ਹਾਂਜੀ ਹੋਰ ਕੁਝ ਪੁੱਛਣਾ ਜੀ ਹਾਂਜੀ ਹੋਰ ਵੀ ਹੈਗੇ ਨੇ ਨੇੜੇ ਤੇੜੇ ਗੁਰਦੁਆਰਾ ਸਾਹਿਬ ਜੀ ਹਾਂਜੀ ਹਾਂਜੀ ਹਾਂਜੀ ਅੱਛਾ ਜੀ ਠੀਕ ਠੀਕ ਹੈ ਜੀ ਹਾਂਜੀ ਹਾਂਜੀ ਕੋਈ ਨਹੀਂ ਉੱਥੇ ਹੋ ਜਾਏਗਾ ਹਾਂਜੀ ਉਹਦੀ ਨਾ ਪਰਵਾਹ ਕਰਿਓ ਜੀ ਠੀਕ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ